ਹਾਂਜੀ ਡਾਕਟਰ ਸਾਹਿਬ ਕੀ ਹਾਲ ਨੇ ਹੋਰ ਕੀ ਚਲਦਾ ਏ ਕੋਲਜ ਦਾ ਹਾਲ ਚਾਲ ਇਲੈਕਟ੍ਰੀਕਲ ਇਹ ਕੀ ਕਾਰਨ ਕੀ ਹੋ ਸਕਦਾ ਆ ਜਿਹੜੇ ਬੱਚੇ ਜ਼ਿਆਦਾ ਕੰਪਿਊਟਰ ਵਾਲੇ ਪਾਸੇ ਭੱਜ ਰਹੇ ਕੰਪਿਊਟਰ ਦੀਆਂ ਸੀਟਾਂ ਭੱਜ ਭੱਜ ਕੇ ਭਰਦੇ ਨੇ ਬਾਕੀ ਪਹਿਲੇ ਤਾਂ ਇਲੈਕਟ੍ਰੋਨਿਕਸ ਦਾ ਬਹੁਤ ਟਰੈਂਡ ਸੀਗਾ ਫਿਰ ਇਲੈਕਟ੍ਰੀਕਲ ਮਕੈਨੀਕਲ ਦਾ ਬਹੁਤ ਟਰੈਂਡ ਸੀ ਮਕੈਨੀਕਲ ਨੂੰ ਕਈ ਵਾਰੀ ਐਵਰਗਰੀਨ ਕਹਿੰਦੇ ਸੀ ਆਪਾਂ ਆਪਣੇ ਟਾਈਮ 'ਚ ਤਾਂ ਸੀਟਾਂ ਨਹੀਂ ਸੀ ਮਿਲਦੀਆਂ ਹੁੰਦੀਆਂ ਹਾਂਜੀ ਹਾਂਜੀ ਹੈ ਸਹੀ ਆਹ ਵਰਕ ਫਰੋਮ ਹੋਮ ਹੋ ਗਿਆ ਹਮ ਹਮ ਹਮ ਨਾਲੇ ਕੰਪਿਊਟਰ ਵਿੱਚ ਨਾ ਅੱਜ ਕੱਲ੍ਹ ਜੋਬ ਦੀ ਬੜੀ ਹਾਈ ਪੇਡ ਹੋ ਗਈਆਂ ਨੇ ਹੁਣ ਸੋਫਟਵੇਅਰ ਕੰਪਨੀਆਂ ਪੈਸੇ ਹੀ ਬਹੁਤ ਦਿੰਦੀਆਂ ਨੇ ਬੜਾ ਹਾਈ ਪੈਕਜ ਹੁੰਦਾ ਉਹਨਾਂ ਦਾ ਹਾਂ ਹਾਂ ਸਹੀ ਗੱਲ ਹੈ ਅੱਜ ਕੱਲ੍ਹ ਤਾਂ ਬਹੁਤ ਫਾਸਟ ਔਰ ਰੇਸ ਵੀ ਬੜੀ ਹਾਈ ਹੈ ਔਰ ਬੱਚਾ ਬੜੀ ਹਾਈ ਲੈਵਲ 'ਤੇ ਪਹੁੰਚ ਜਾਂਦਾ ਮਿਹਨਤ ਕਰਕੇ ਨਾਲੇ ਮੇਨ ਗੱਲ ਇੱਧਰ ਇਹ ਵੀ ਹੈ ਕਿ ਇੰਟਰਨੈਸ਼ਨਲ ਲੈਵਲ 'ਤੇ ਪਹੁੰਚ ਗਿਆ ਜਿਹੜਾ ਸੋਫਟ ਇੰਜੀਨੀਅਰਿੰਗ ਦੀ ਜੋਬ ਹੈ ਕਲਾਇੰਟਸ ਉਹਦੇ ਅਮਰੀਕਾ ਬੈਠੇ ਹੁੰਦੇ ਨੇ ਜਾਂ ਕੈਨੇਡਾ ਬੈਠੇ ਹੁੰਦੇ ਨੇ ਅਤੇ ਉਰੇ ਬਹਿ ਕੇ ਸਾਰਾ ਵਰਕ ਫਰੋਮ ਹੋਮ ਕਰਕੇ ਆਰਾਮ ਨਾਲ ਕੰਮ ਕਰਦੇ ਨੇ ਉਹ ਆਪਣੀ ਸਹੂਲਤ ਦੇ ਹਿਸਾਬ ਨਾਲ ਹਾਂ ਹਮ ਹਾਂ ਇਹ ਵੀ ਗੱਲ ਹੈਗੀ ਆ

ਠੀਕ ਹੈ ਫਿਰ ਸਤਿ ਸ਼੍ਰੀ ਅਕਾਲ